ਸਤਿ ਸ਼੍ਰੀ ਅਕਾਲ ਜਦੋਂ ਮੈਂ ਬਾਰਵੀਂ ਕੀਤੀ ਸੀ ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅੱਗੇ ਮੈਂ ਕਿਹੜੀ ਪੜ੍ਹਾਈ ਕਰਾਂ ਮਤਲਬ ਮੈਂ ਕਿਸ ਵਿੱਚ ਦਾਖਲਾ ਲਵਾਂ ਉਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਫਿਰ ਮੈਂ ਆਪਣੇ ਤਾਊ ਜੀ ਦੇ ਮੁੰਡੇ ਤੋਂ ਪੁੱਛਣਾ ਜਾਇਜ ਸਮਝਿਆ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਹੁਸ਼ਿਆਰ ਹਨ ਉਸ ਜਿਹੜਾ ਮੇਰੇ ਤਾਊ ਦਾ ਵੱਡਾ ਮੁੰਡਾ ਹੈ ਉਸ ਦੇ ਘਰ ਵਿੱਚ ਬਹੁਤ ਹੀ ਮੰਨੀ ਜਾਂਦੀ ਹੈ ਅਤੇ ਉਹਨੂੰ ਬਹੁਤ ਹੀ ਸਮਝਦਾਰ ਸਮਝਿਆ ਜਾਂਦਾ ਹੈ ਉਹ ਮੇਰੇ ਬਾਰੇ ਸਭ ਬਚਪਨ ਤੋਂ ਹੀ ਸਭ ਕੁਝ ਜਾਣਦੇ ਹਨ ਮੈਂ ਉਹਨਾਂ ਤੋਂ ਸਲਾਹ ਲਈ ਕਿ ਮੈਨੂੰ ਦੱਸ ਦਿਓ ਕਿ ਮੈਂ ਅੱਗੇ ਕੀ ਕਰਾਂ ਕਿਉਂਕਿ ਮੈਨੂੰ ਸਮਝ ਆ ਹੀ ਨਹੀਂ ਰਿਹਾ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਬੀਟੈਕ ਕੀਤੀ ਹੋਈ ਆ ਮੇਰੀ ਭੈਣ ਵੀ ਬੀਟੈਕ ਕੀਤੀ ਹੋਈ ਹੈ ਅਤੇ ਮੇਰਾ ਇੱਕ ਛੋਟਾ ਬ੍ਰਦਰ ਆ ਉਹਨੇ ਵੀ ਬੀਟੈਕ ਹੀ ਕੀਤੀ ਹੋਈ ਹੈ ਅਤੇ ਹੁਣ ਹਾ ਸਾਡੀ ਤਿੰਨ ਦੀ ਨੌ ਨੌਕਰੀ ਲੱਗੀ ਹੋਈ ਹੈ ਅਤੇ ਤੂੰ ਵੀ ਬੀਟੈਕ ਹੀ ਕਰ ਲੈ ਸਾਨੂੰ ਉਮੀਦ ਹੈ ਕਿ ਤੀ ਤੂੰ ਬੀਟੈਕ ਕਰ ਸਕਦੀ ਹੈ ਫਿਰ ਮੈਨੂੰ ਇੱਕ ਕੋਲਜ ਦਾ ਸਮਝ ਨਹੀਂ ਆ ਰਿਹਾ ਸੀ ਫਿਰ ਉਹਨਾਂ ਨੇ ਦੱਸਿਆ ਕਿ ਕਾਲਜ ਜੀ ਐ ਡ ਯੂ ਇੱਕ ਹੈਗਾ ਜੋ ਕਿ ਅੰਮ੍ਰਿਤਸਰ ਵਿੱਚ ਹੈ ਉਹ ਤੇ ਅਲੱਗ ਅਲੱਗ ਦੇਸ਼ ਦੇ ਲੋਕ ਵੀ ਪੜ੍ਹਨ ਲਈ ਆਉਂਦੇ ਹਨ ਅਤੇ ਅਲੱਗ ਅਲੱਗ ਦੇਸ਼ ਦੇ ਟੀਚਰਸ ਸਿਲੈਕਟ ਕੀਤੇ ਜਾਂਦੇ ਹਨ ਅਤੇ ਫਿਰ ਮੈਂ ਉੱਥੇ ਦਾਖਲਾ ਲਿਆ ਹੁਣ ਮੇਰਾ ਤੀਸਰਾ ਸਾਲ ਹੈ ਅਤੇ ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਮੈਂ ਉੱਥੇ ਦਾਖਲਾ ਲੈ ਕੇ ਬਹੁਤ ਹੀ ਵਧੀਆ ਕੀਤਾ ਅਤੇ ਮੈਨੂੰ ਉਮੀਦ ਹੈ ਕਿ ਮੇਰੀ ਅਗਲੇ ਸਾਲ ਵਿੱਚ ਨੌਕਰੀ ਵੀ ਲੱਗ ਜਾਵੇਗੀ ਹਾਂਜੀ ਧੰਨਵਾਦ ਜੀ